ਅੱਜ ਕੱਲ੍ਹ ਰਾਜਨੀਤਿਕ ਲੋਕ ਧਰਮ ਦਾ ਸਹਾਰਾ ਲੈਂਦੇ ਹਨ ਜੇਕਰ ਇਹਨਾਂ ਨੇ ਵੋਟਾਂ ਲੈਣੀਆਂ ਹੋਣ ਤਾਂ ਇਨ੍ਹਾਂ ਨਾਲ ਧਰਮ ਦਾ ਫਾਇਦਾ ਚੁੱਕਦੇ ਹਨ ਜਿਸ ਧਰਮ ਦੇ ਪਿੱਛੇ ਲੋਕ ਜ਼ਿਆਦਾਤਰ ਹੁੰਦੇ ਹਨ ਉਸ ਧਰਮ ਦੇ ਇਹ ਰਾਜਨੀਤਿਕ ਲੋਕ ਆਪਣੇ ਕੰਮ ਧੰਦੇ ਕਰਵਾਉਂਦੇ ਹਨ ਜੋ ਕਿਸੇ ਧਰਮ ਰਾਹੀਂ ਕੋਈ ਢੰਗਾ ਚੰਗਾ ਕੰਮ ਕੀਤਾ ਜਾਂਦਾ ਹੈ ਤਾਂ ਉਸ ਪਿੰਡ ਪਿੰ ਪਿੰਡ ਇਹ ਆਪਣਾ ਨਾਮ ਜੋੜ ਲੈਂਦੇ ਹਨ ਜਿਸ ਪ੍ਰਕਾਰ ਮਸੀਹ ਵਾਲੇ ਪੱਥਰ ਅਤੇ ਲੋਕਾਂ ਦਾ ਨੂੰ ਗੁੰਮਰਾਹ ਕਰਕੇ ਇਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਹਨ ਇਹਨਾਂ ਦੀਆਂ ਬਿਮਾਰੀਆਂ ਦਾ ਛੁਟਕਾਰਾ ਕਰਦੇ ਹਨ ਦੁਆ ਕਰਕੇ ਕੁਝ ਲੋਕ ਧਾਗੇ ਤਵੀਤਾਂ ਦਾ ਪ੍ਰਯੋਗ ਵੀ ਕਰਦੇ ਹਨ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹ ਸਾਡੀ ਅਨਪੜ੍ਹਤਾ ਦੀ ਵੱਡੀ ਨਿਸ਼ਾਨੀ ਹੈ ਕੁਝ ਲੋਕ ਬਲੀਆਂ ਦੇਣ ਵਿੱਚ ਵਿਸ਼ਵਾਸ ਕਰਦੇ ਹਨ ਇਹਨਾਂ ਤੋਂ ਲੋਕ ਆਪਣਾ ਰੁਜ਼ਗਾਰ ਬਣਾਉਂਦੇ ਹਨ ਸਾਨੂੰ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਝੂਠ ਪਖੰਡਾਂ ਨਾਲ ਸਾਡਾ ਕੁਝ ਨਹੀਂ ਹੁੰਦਾ ਇਹ ਸਿਰਫ ਇੱਕ ਰੁਜ਼ਗਾਰ ਦਰ ਦਾ ਸਾਧਨ ਹੈ